ਮੈਂ ਜੋ ਵੀ ਕੰਮ ਕਰਦੀ ਹਾਂ ਬਹੁਤ ਮਿਹਨਤ ਨਾਲ ਕਰਦੀ ਹਾਂ ਸੋਚ ਸਮਝ ਕੇ ਕਰਦੀ ਹਾਂ ਉਸ ਦੇ ਫਾਇਦੇ ਅਤੇ ਨੁਕਸਾਨ ਨੂੰ ਸੋਚ ਕੇ ਇਹ ਵੀ ਧਿਆਨ ਰੱਖਦੀ ਹਾਂ ਕਿ ਉਸ ਕੰਮ ਨੂੰ ਕਰਨ ਨਾਲ ਕਿਸੇ ਦਾ ਨੁਕਸਾਨ ਨਾ ਹੋਵੇ ਅਤੇ ਕੰਮ ਵਧੀਆ ਤਰੀਕੇ ਨਾਲ ਕੀਤਾ ਜਾਵੇ ਅਤੇ ਕੰਮ ਦਾ ਫਾਇਦਾ ਹੀ ਹੋਵੇ ਅਤੇ ਉਹ ਕੰਮ ਜਿਹੜਾ ਏ ਫਿਊਚਰ ਵਿੱਚ ਵੀ ਉਸਦਾ ਫਾਇਦਾ ਹੋਵੇ ਅਤੇ ਕਿਸੇ ਨੂੰ ਉਸ ਕੰਮ ਦੇ ਕੀਤੇ ਨਾਲ ਨੁਕਸਾਨ ਨਾ ਹੋਵੇ ਅਤੇ ਹਰ ਪੱਖੋਂ ਉਹ ਕੰਮ ਵਧੀਆ ਹੋਵੇ